ਸਤਿ ਸ਼੍ਰੀ ਅਕਾਲ ਜੀ ਮੈਂ ਸ਼ਿਵ ਕਾਰਟਲਿਆਂ ਦੇ ਨਾਲ ਹੋ ਰਹੀ ਹੈ ਗੱਲ ਜੀ ਹਾਂਜੀ ਮੈਂ ਤੁਹਾਡੇ ਪਹਿਲਾਂ ਪ੍ਰੋਡਕਟ ਖਰੀਦਿਆ ਸੀ ਫੋਨ ਲਿਆ ਸੀ ਸਮਸੰਗ ਦਾ ਉਹੀ ਉਹਦੀ ਕੁਆਲਿਟੀ ਇੰਨੀ ਵਧੀਆ ਵਾ ਨਾ ਕਿ ਉਹਦਾ ਕੈਮਰਾ ਇੰਨਾਂ ਜ਼ਿਆਦਾ ਐੱਚ ਡੀ ਹੈ ਉਹਦੀ ਫੋਟੋ ਜਿੰਨੀ ਸੋਹਣੀ ਆਉਂਦੀ ਆ ਜਿੰਨਾਂ ਮ ਜੂਮ ਕਰਕੇ ਮਰਜ਼ੀ ਖਿੱਚ ਲਓ ਉਹਦੇ ਪਿਕਸਲ ਨਹੀਂ ਪਾੜਦੇ ਉਹ ਬਹੁਤ ਹੀ ਚੰਗੀ ਫੋਟੋ ਖਿੱਚਦਾ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਮੈਮਰੀ ਦੀ ਵੀ ਹੈ ਇਹਦੀ ਚੌਂਹਠ ਇੱਕ ਸੌ ਅਠਾਈ ਹੀ ਆ ਮੈਂ ਇਹਦੇ ਵਿੱਚ ਕਿੰਨੇ ਹੀ ਐਪ ਭਰ ਲਏ ਹਨ ਅਤੇ ਗੈਲਰੀ ਵਿੱਚ ਕਿੰਨੀਆਂ ਹੀ ਫੋਟੋਆਂ ਭਰ ਲਈਆਂ ਹਨ ਪਰ ਇਹਦੀ ਜਿਹੜੀ ਮੈਮਰੀ ਹੈ ਬਹੁਤ ਹੀ ਵਧੀਆ ਲੱਗੀ ਹੈ ਜੀ ਮੇਰਾ ਫੋਨ ਜਮਾਂ ਵੀ ਹੈਂਗ ਨਹੀਂ ਹੁੰਦਾ ਇਹਦਾ ਜੇ ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਕਵਰ ਦੀ ਉਹ ਇੰਨਾਂ ਜ਼ਿਆਦਾ ਇਹਦਾ ਰੰਗ ਵਧੀਆ ਅੱਖਾਂ ਅੱਖਾਂ ਨੂੰ ਇੰਨਾਂ ਪ੍ਰਭਾਵਿਤ ਕਰਦਾ ਕਿ ਇੰਨਾਂ ਚੰਗਾ ਹੀ ਆ ਦੇਖ ਕੇ ਦੂਰੋਂ ਪਤਾ ਲੱਗਦਾ ਕਿ ਫੋਨ ਚੜਿਆ ਹੈ ਫੜਿਆ ਹੈ ਬਹੁਤ ਹੀ ਵਧੀਆ ਲੱਗਿਆ ਮੈਨੂੰ ਇਹਦੀ ਇਹਦੀ ਹੋਰ ਵੀ ਕਈ ਤਰ੍ਹਾਂ ਦੀਆਂ ਚੰਗੀਆਂ ਕੁਆਲਟੀਆਂ ਦਾ ਫੋਨ ਮੈਨੂੰ ਫੋਨ ਬੜਾ ਹੀ ਜ਼ਿਆਦਾ ਪਸੰਦ ਆਇਆ ਹੈ ਆਇਆ ਮੌਕੇ ਟਾਈਮ ਨਹੀਂ ਸੀਗਾ ਪਹਿਲਾਂ ਮੈਂ ਸੋਚਿਆ ਸੀ ਦੁਕਾਨ ਤੋਂ ਲੈ ਕੇ ਆਉਂਦਾ ਸੀ ਪਰ ਜੇ ਔਨਲਾਈਨ ਲੈ ਲਵਾਂ ਤਾਂ ਮੈਨੂੰ ਕੋਈ ਵੀ ਇਹਦਾ ਦੁੱਖ ਨਹੀਂ ਲੱਗਾ ਕਿਉਂਕਿ ਇਹ ਫੋਨ ਬੜਾ ਹੀ ਚੰਗਾ ਫੋਨ ਨਿਕਲਿਆ ਬੜਾ ਹੀ ਵਧੀਆ ਵਾ ਧੰਨਵਾਦ ਜੀ